ਮੈਂ ਆਪਣੀ ਪਰਿਵਾਰ ਨਾਲ ਘੁੰਮਣਾ ਪਸੰਦ ਕਰਦੀ ਹਾਂ ਕਿਉਂਕਿ ਪਰਿਵਾਰ ਨਾਲ ਘੁੰਮਣਾ ਸਾਨੂੰ ਮੈਨੂੰ ਬਹੁਤ ਚੰਗਾ ਲੱਗਦਾ ਹੈ ਪਰਿਵਾਰ ਨਾਲ ਬਾਹਰ ਜਾ ਕੇ ਸਾਡਾ ਮਨ ਬਹੁਤ ਖੁਸ਼ ਹੋ ਜਾਂਦਾ ਹੈ ਘਰ ਰਹਿ ਕੇ ਸਾਡਾ ਪਰਿਵਾਰ ਨਾਲ ਰਿਸ਼ਤਾ ਵਧੀਆ ਨਹੀਂ ਹੁੰਦਾ ਕਿਉਂਕਿ ਘਰ ਬੱਚੇ ਸਕੂਲ ਚਲੇ ਜਾਂਦੇ ਹਨ ਹਸਬੈਂਡ ਖੇਤ ਵਿੱਚ ਚਲੇ ਜਾਂਦੇ ਹਨ ਇਸ ਕਰਕੇ ਅਸੀਂ ਵੀਕਐਂਡ ਵਿੱਚ ਆਪਣੇ ਪਰਿਵਾਰ ਨਾਲ ਬਾਹਰ ਜਾਣਾ ਪਸੰਦ ਕਰਦੇ ਹਾਂ ਉੱਥੇ ਜਾ ਕੇ ਸਾਨੂੰ ਵਧੀਆ ਲੱਗਦਾ ਹੈ ਬੱਚੇ ਬਹੁਤ ਖੁਸ਼ ਹੁੰਦੇ ਹਨ ਉੱਥੇ ਜਾ ਕੇ ਸਾਡਾ ਮਾਇੰਡ ਫਰੈੱਸ਼ ਹੋ ਜਾਂਦਾ ਹੈ ਘਰ ਰਹਿ ਕੇ ਅਸੀਂ ਆਪਣੇ ਪਰਿਵਾਰ ਨਾਲ ਮਿਲ ਜੁਲ ਕੇ ਨਹੀਂ ਬੈਠਦੇ ਕਿਉਂਕਿ ਘਰ ਅਸੀਂ ਆਪਣਾ ਕੰਮ ਵਿੱਚ ਹੀ ਟਾਈਮ ਲੰਘ ਜਾਂਦਾ ਹੈ ਬਾਹਰ ਜਾਣ ਨਾਲ ਸਾਡਾ ਮਨ ਵਧੀਆ ਬਣ ਜਾਂਦਾ ਕਿਉਂਕਿ ਉੱਥੇ ਰਹਿ ਕੇ ਬੱਚੇ ਅਤੇ ਸਾਰਾ ਪਰਿਵਾਰ ਇੱਕ ਦੂਜੇ ਨਾਲ ਰਲ ਮਿਲ ਕੇ ਖੁਸ਼ੀ ਖੁਸ਼ੀ ਰਹਿੰਦੇ ਹਾਂ ਬਾਹਰ ਜਾ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਥੈਂਕ ਯੂ